ਵਿਗਿਆਨ ਨੇ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਅਧਿਐਨ ਕਰਨ ਵਿੱਚ ਬਹੁਤ ਹੀ ਮਦਦ ਕੀਤੀ ਹੈ ਲੋਕ ਮੋਬਾਈਲ 'ਤੇ ਬਹੁਤ ਕੁਝ ਸਿੱਖਦੇ ਹਾਂ ਜਿ ਜਿਸ ਕਿਸੇ ਵਿਸ਼ੇ ਦੀ ਜਾਣਕਾਰੀ ਚਾਹੀਦੀ ਹੈ ਉਸਨੂੰ ਅਸੀਂ ਬੋਲ ਕੇ ਗੂਗਲ 'ਤੇ ਸਰਚ ਕਰ ਸਕਦੇ ਹਾਂ ਅਤੇ ਉਸ ਬਾਰੇ ਸਾਨੂੰ ਪੂਰਾ ਗਿਆਨ ਹੋ ਜਾਂਦਾ ਹੈ ਲੋਕ ਪੈਸੇ ਵੀ ਹੁਣ ਔਨਲਾਈਨ ਹੀ ਭੁਗਤਾਨ ਕਰਦੇ ਹਾਂ ਜਾਂ ਪੇਟੀਐਮ ਦੇ ਇਸਤੇਮਾਲ ਕਰਦੇ ਹਾਂ ਸਗੋਂ ਬੱਚੇ ਘਰ ਬਹਿ ਕੇ ਹੀ ਔਨਲਾਈਨ ਦੀ ਸਹਾਇਤਾ ਨਾਲ ਆਪਣੀ ਸਟੱਡੀ ਅਤੇ ਬਾਕੀ ਵਿਸ਼ਿਆਂ ਦੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਹੁਣ ਅਸੀਂ ਡਿਜੀਟਲ ਸਿਖਲਾਈ ਨਾਲ ਸਾਨੂੰ ਬਹੁਤ ਹੀ ਫ਼ਾਇਦੇ ਹੁੰਦੇ ਹਨ